ਬਜ਼ਾਰ ਵਿੱਚ ਤਿਆਰ ਕੱਪੜਿਆਂ ਨਾਲੋਂ ਹੱਥਾਂ ਦੇ ਕੱਪੜੇ ਬਣਾਏ ਤਾਂ ਪਸੰਦ ਕਰਦੇ ਆ ਪੀ ਜਿਵੇਂ ਉਹਨਾਂ ਵਿੱਚ ਇੱਕ ਤਾਂ ਨਿੱਘ ਬਹੁਤ ਹੁੰਦਾ ਵਾ ਅਤੇ ਇੱਕ ਉਹ ਸਸਤੇ ਪੈ ਜਾਂਦੇ ਸਾਨੂੰ ਵੀ ਸਾਨੂੰ ਜ਼ਿਆਦਾ ਉਹ ਵੀ ਘਰ ਵਿੱਚ ਜਨਾਨੀਆਂ ਵਹਿਲੀਆਂ ਹੋਣ ਕਰਕੇ ਉਹ ਆਮ ਹੀ ਕੱਪੜੇ ਬੁਣਦੀਆਂ ਰਹਿੰਦੀਆਂ ਵਾਂ ਜੇ ਸਿਲਾਈ ਵਾਲਾ ਕੰਮ ਆ ਅਤੇ ਘਰੇ ਸੀਕੇ ਬੱਚੇ ਨੂੰ ਕੱਪੜੇ ਪਾ ਦਿੰਦੀਆਂ ਵਾਂ ਟੋਟਿਆਂ 'ਚ ਵੀ ਬੱਚਿਆਂ ਦੇ ਕੱਪੜੇ ਬਣ ਜਾਂਦੇ ਜੇ ਵੱਡਿਆਂ ਦੇ ਸੂਟ ਲਿਆਈਦੇ ਤਾਂ ਨਿੱਕੇ ਨੇ ਬੱਚਿਆਂ ਦੇ ਨਾਲ ਆਮ ਬਣ ਜਾਂਦੇ ਆ ਅਤੇ ਇਹ ਜੇ ਰੈਡੀਮੇਡ ਕੱਪੜਿਆਂ ਦੀ ਇੱਕ ਵੱਡੀ ਮਾਰਕੀਟ ਹੋਵੇ ਅਤੇ ਉਹਦੇ ਜਿਹੜੇ ਲੋਕ ਆ ਉਹ ਫਿਰ ਵੀ ਸਿਲਾਈ ਦੇ ਕੱਪੜੇ ਸਿਊ ਕੇ ਪਾਉਣਾ ਪਸੰਦ ਕਰਦੇ ਆ ਨਾ ਕਿ ਕੱਪੜੇ ਖਰੀਦਣਾ ਪਸੰਦ ਕਰਦੇ ਆ ਕਿਉਂਕਿ ਉਹਨਾਂ ਨੂੰ ਉਹ ਸੌਖੇ ਪੈਂਦੇ ਆ ਅਤੇ ਉਹਦੇ ਵਿੱਚ ਇੱਕ ਤਾਂ ਟੈਮ ਦੀ ਬੱਚਤ ਹੋ ਜਾਂਦੀ ਦੂਰ ਜਾਣਾ ਨਹੀਂ ਪੈਂਦਾ ਸਾਨੂੰ ਬਜ਼ਾਰ ਮਾਰਕੀਟ ਹੋਣ ਦੇ ਬਾਵਜੂਦ ਵੀ ਲੋਕ ਸੋਚਦੇ ਆ ਵੀ ਜੇ ਘਰੇ ਬਣਾ ਲੇ ਜਾਣਗੇ ਤਾਂ ਸਾਨੂੰ ਫਾਇਦਾ ਹੀ ਆ ਸਾਨੂੰ ਕੋਈ ਦੂਰ ਨੀ ਜਾਣਾ ਪਊਗਾ ਸਾਡੇ ਬੱਚੇ ਦੇ ਨਾਲ ਫ੍ਰੀ 'ਚ ਸੂਟ ਬਣ ਜਾਣਾ ਵਾ ਇਸ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਸਾਰੀਆਂ ਕਰਨੀਆਂ ਪਸੰਦ ਲੱਗਦੀਆਂ ਨਾਲੇ ਫ੍ਰੀ ਬੇਠੀਆਂ ਹੁੰਦੀਆਂ ਜਨਾਨੀਆਂ ਘਰ ਉਹਨਾਂ ਨੇ ਕਿਹੜੇ ਕੋਈ ਕੰਮ ਹੋਰ ਫਾਲਤੂ ਹੁੰਦੇ ਘਰ ਦੇ ਕੰਮ ਰੋਟੀ ਪਾਣੀ ਬਣਾਇਆ ਬੱਚਿਆਂ ਨੂੰ ਸਕੂਲ ਭੇਜਿਆ ਅਤੇ ਫਿਰ ਵੇ ਫ੍ਰੀ ਹੋ ਕੇ ਅਤੇ ਉਹ ਇਹੀ ਕੰਮ ਕਰ ਲੈਂਦੀਆਂ ਕਿ ਚਲ ਘਰ ਵਿੱਚ ਸਿਲਾਈ ਨਾਲ ਬੱਚਿਆਂ ਦੇ ਕੋਟੀਆਂ ਬਣਾ ਲਓ ਜੇ ਫ੍ਰੀ ਹੈ ਜੇ ਜੇ ਸੂਟ ਸਿਊ ਲਓ ਬੱਚਿਆਂ ਦੇ ਜਿਹਦੇ ਨਾਲ ਬੱਚੇ ਖੁਸ਼ ਹੋ ਜਾਂਦੇ ਨਾਲੇ ਘਰ ਦੇ ਮਾਂ ਨਾਲ ਦਾ ਸੂਟ ਪਾ ਕੇ ਧੀਆਂ ਖੁਸ਼ ਹੋ ਜਾਂਦੀਆਂ ਵਾਂ ਬੱਚਿਆਂ ਦੇ ਕੁੜਤੇ ਪਜਾਮੇ ਬਣਾ ਲਈਦੇ ਆ ਘਰੇ ਅਤੇ ਸਾਰੇ ਕੰਮ ਕਰਕੇ ਸਾਰੇ ਵੀ ਨਾਲੇ ਘਰ ਦੇ ਖੁਸ਼ ਨਾਲੇ ਆਪ ਖੁਸ਼ ਨਾਲੇ ਬੱਚੇ ਖੁਸ਼ ਹੋ ਜਾਂਦੇ ਆ